ਭੰਗੜਾ ਸਾਡੇ ਪੰਜਾਬੀ ਕਲਚਰ ਦੀ ਪਹਿਚਾਣ ਹੈ ਭੰਗੜਾ ਦੇ ਨਾਲ ਹੀ ਪੰਜਾਬੀ ਜਾਣੇ ਜਾਂਦੇ ਹਨ ਭੰਗੜਾ ਇਸ ਕਰਕੇ ਵੀ ਪਾਇਆ ਜਾਂਦਾ ਹੈ ਇਹਦੇ ਨਾਲ ਸਾਡੀ ਸਿਹਤ ਵੀ ਠੀਕ ਰਹਿੰਦੀ ਹੈ ਭੰਗੜਾ ਸਾਡੇ ਪੰਜਾਬੀਆਂ ਦੀ ਸ਼ਾਨ ਤਾਂ ਹੈ ਹੀ ਹੈ ਇਸ ਤੋਂ ਹੀ ਸਾਡੇ ਪੰਜਾਬੀ ਜਾਣੇ ਜਾਂਦੇ ਹਨ ਭੰਗੜਾ ਇਸ ਕਰਕੇ ਵੀ ਪਾਇਆ ਜਾਂਦਾ ਹੈ ਭੰਗੜਾ ਹੋਰਾਂ ਨਾਲੋਂ ਅਲੱਗ ਵੀ ਹੁੰਦਾ ਹੈ ਅਤੇ ਭੰਗੜਾ ਸਾਡੀ ਪਹਿਚਾਣ ਵੀ ਬਣ ਸਕਦਾ ਹੈ